ਅਸੀਂ ਰਸੋਈ ਦੇ ਵਿੱਚ ਬੜੇ ਅਲੱਗ ਅਲੱਗ ਤਰ੍ਹਾਂ ਦੇ ਬਰਤਨ ਯੂਜ ਕਰਦੇ ਹਾਂ ਜਿਸ ਵਿੱਚ ਪਤੀਲਾ ਕੜਛੀ ਕੜਾਹੀ ਕੁੱਕਰ ਚਮਚ ਥਾਲੀ ਗਿਲਾਸ ਫਰਾਈ ਪੈਨ ਕੱਦੂ ਕੱਦੂਕਸ ਹੋਰ ਬਹੁਤ ਤਰ੍ਹਾਂ ਦੇ ਬਰਤਨ ਹੈ ਅਤੇ ਜਿਵੇਂ ਪਤੀਲਾ ਸੀ ਦੁੱਧ ਬੋਇਲ ਕਰਨ ਦੇ ਲਈ ਪਾਣੀ ਗਰਮ ਕਰਨ ਦੇ ਲਈ ਯੂਜ਼ ਹੁੰਦਾ ਕੜਛੀ ਹਮੇਸ਼ਾ ਜਦੋਂ ਆਪਾਂ ਕੋਈ ਚੀਜ਼ ਬਣਾ ਰਹੇ ਹਾਂ ਉਸਨੂੰ ਘੁਮਾਉਣ ਵਾਸਤੇ ਹਿਲਾਉਣ ਵਾਸਤੇ ਕੜਛੀ ਹੁੰਦੀ ਹੈ ਕੜਾਹੀ ਦੇ ਵਿੱਚ ਨੋਰਮਲੀ ਤੇਲ ਕਰ ਤੇਲ ਪਾ ਕੇ ਅਸੀਂ ਕੁਝ ਨਾ ਕੁਝ ਉਹਦੇ 'ਤੇ ਫਰਾਈ ਕਰ ਸਕਦੇ ਹਾਂ ਪਕੋੜੇ ਬਣਾਉਣਾ ਕੜ੍ਹੀ ਬਣਾਉਣੀ ਜੇ ਖੁੱਲੇ ਭਾਂਡੇ 'ਚ ਕੁਛ ਵੀ ਚੀਜ਼ ਬਣਾਉਣੀ ਹੋਵੇ ਕੜਾਹੀ 'ਚ ਬਣਾਈ ਜਾ ਸਕਦੀ ਹੈ ਕੂਕਰ ਹਮੇਸ਼ਾ ਦਾਲਾਂ ਬਣਾਉਣ ਵਾਸਤੇ ਚਾਵਲ ਬਣਾਉਣ ਵਾਸਤੇ ਜਿੱਥੇ ਉੱਪਰ ਅਸੀਂ ਕੋਈ ਢੱਕ ਕੇ ਚੀਜ਼ ਬਣਾ ਸਕਦੇ ਹਾਂ ਉਹ ਕੂਕਰ ਇਸਤੇਮਾਲ ਨੂੰ ਹੁੰਦਾ ਹੈ ਬਾਕੀ ਥਾਲੀ ਜਿਹੜੀ ਹੈਗੀ ਹੈ ਫੁੱਲਕੇ ਰੱਖਣ ਵਾਸਤੇ ਜਾਂ ਖਾਣਾ ਖਾਣਾ ਉਹਦੇ ਵਾਸਤੇ ਯੂਜ ਕਰਦੇ ਹਾਂ ਚਮਚ ਜਿਹੜਾ ਹੈ ਉਹ ਸਬਜ਼ੀ ਖਾਣ ਲਈ ਯੂਜ ਹੁੰਦਾ ਗਿਲਾਸ ਜਿਹੜਾ ਹੈ ਚਾਹ ਦੇ ਲਈ ਦੁੱਧ ਦੇ ਲਈ ਪਾਣੀ ਦੇ ਲਈ ਜਾਂ ਜਿਹੜੇ ਕੋਈ ਹੋਰ ਲਿਕ਼ਉਆੱਡ ਜੂਸ ਵਗੈਰਾ ਹੋਣ ਉਹਨਾਂ ਦੇ ਲਈ ਇਸਤੇਮਾਲ ਕੀਤਾ ਜਾਂਦਾ